ਸਾਡੇ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਬਹੁਤ ਪੁਰਾਣੇ ਟਾਈਮ ਦੀ ਚੱਲਦੀ ਆ ਰਹੀ ਹੈ ਜਿੱਦਾਂ ਬ੍ਰਿਟਿਸ਼ਰਸ ਦੇ ਟਾਈਮ ਦੀ ਕੁਛ ਐਜੂਕੇਸ਼ਨ ਸਿਮਟਮ ਇੱਥੇ ਫੋਲੋ ਹੋ ਰਿਹਾ ਹੈ ਜਿਹੜਾ ਕਿ ਸਾਨੂੰ ਬਦਲਣਾ ਚਾਹੀਦਾ ਹੈ ਜੇ ਆਪਾਂ ਬਾਹਰ ਦੇ ਦੇਸ਼ਾਂ ਨਾਲ ਕੰਪੇਅਰ ਕਰੀਏ ਇਹਨੂੰ ਤਾਂ ਸਾਡਾ ਬਹੁਤ ਅਸੀਂ ਪਿੱਛੇ ਹੈਗੇ ਹਾਂ ਜ਼ਿਆਦਾ ਸਾਡੇ ਇੱਥੇ ਇਹ ਚੀਜ਼ ਦਾ ਜ਼ੋਰ ਦਿੱਤਾ ਜਾਂਦਾ ਹੈ ਕਿ ਬੱਚਾ ਰੱਟੇ ਜ਼ਿਆਦਾ ਮਾਰੇ ਅਤੇ ਸਮਝੇ ਨਾ ਹੁਣ ਸਾਨੂੰ ਕਈ ਇੱਦਾਂ ਦੇ ਸਬਜੈਕਟਸ ਪੜ੍ਹਾਏ ਜਾ ਰਹੇ ਨੇ ਜਾਂ ਸਾਨੂੰ ਕਈ ਉਹ ਚੀਜ਼ਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਹੜਾ ਸਾਡੇ ਮਤਲਬ ਜ਼ਿੰਦਗੀ 'ਚ ਸਾਡਾ ਉਹਦਾ ਕੋਈ ਫ਼ਾਇਦਾ ਨੀਗਾ ਸਾਨੂੰ ਉਹ ਪੜ੍ਹਨ ਦਾ ਸਾਨੂੰ ਕੁਛ ਪ੍ਰੈਕਟੀਕਲ ਨਹੀਂ ਕਰਵਾਇਆ ਜਾ ਰਿਹਾ ਉਸ ਬਾਰੇ ਅਤੇ ਜਦੋਂ ਬੱਚਾ ਪੜ੍ਹ ਕੇ ਨਿਕਲ ਜਾਂਦਾ ਹੈ ਇੱਕ ਸਕੂਲ ਤੋਂ ਇੱਕ ਕੋਲੇਜ ਤੋਂ ਅਤੇ ਉਹਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਉਹਨੇ ਹੁਣ ਕਰਨਾ ਕੀ ਹੈ ਜਾ ਕੇ ਉਹਨੇ ਜੋਬ ਕਿਸ ਤਰ੍ਹਾਂ ਲੈਣੀ ਹੈ ਉਹਨੇ ਕੰਮ ਕਿਸ ਤਰ੍ਹਾਂ ਕਰਨਾ ਹੈ ਅਤੇ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮਾਰਕੀਟ 'ਚ ਕਿਸ ਤਰ੍ਹਾਂ ਪ੍ਰੈਕਟੀਕਲੀ ਜੋਬ ਲੈਣੀ ਹੈ ਸਿਰਫ ਅਸੀਂ ਰੱਟਿਆ 'ਤੇ ਡਿਪੈਂਡ ਹਾਂ ਆਪਣੇ ਬੱਚਿਆਂ ਨੂੰ ਰੱਟੇ ਕਰਵਾ ਰਹੇ ਹਾਂ ਅਤੇ ਜਿਹਦੇ ਮਾਰਕਸ ਚੰਗੇ ਆਉਂਦੇ ਹੈ ਰੱਟੇ ਮਾਰ ਮਾਰ ਕੇ ਅਸੀਂ ਉਹਨੂੰ ਆਪਣੀ ਨਜ਼ਰਾਂ 'ਚ ਇੰਟੈਲੀਜੈਂਟ ਸਮਝਦੇ ਹਾਂ ਜਦਕਿ ਬਾਹਰ ਦੇ ਦੇਸ਼ਾਂ 'ਚ ਦੇਖਿਆ ਜਾਵੇ ਅਤੇ ਉਹ ਸਾਰਾ ਕੰਮ ਪ੍ਰੈਕਟੀਕਲ ਕਰਵਾਉਂਦੇ ਨੇ ਉਹਨਾਂ ਨੂੰ ਸਭ ਕੁਛ ਪ੍ਰੈਕਟੀਕਲ ਨੌਲੇਜ ਹੁੰਦੀ ਹੈ ਉਹਨਾਂ ਨੂੰ ਸਾਡਾ ਸਿਰਫ਼ ਇਹ ਹੀ ਫਰਕ ਹੈ ਉਹਨਾਂ ਨਾਲ ਕੀ ਉਹ ਜੋ ਕਰਵਾਉਂਦੇ ਨੇ ਉਹਨਾਂ ਦੇ ਜੋਬ ਪਰਪਸ ਵਾਸਤੇ ਹੁੰਦਾ ਹੈ ਸਾਡੇ ਇੱਥੇ ਬੱਚੇ ਰੱਟੂ ਤੋਤੇ ਜ਼ਿਆਦਾ ਨੇ ਰੱਟੂ ਤੋਤਿਆਂ ਨੂੰ ਇੱਥੇ ਗੁੱਡ ਸਟੂਡੈਂਟ ਚੰਗਾ ਵਿਦਿਆਰਥੀ ਮੰਨਿਆ ਜਾਂਦਾ ਹੈ ਅਤੇ ਐਜ਼ ਕੰਪੇਅਰ ਟੂ ਜਦੋਂ ਅਸੀਂ ਬਾਹਰ ਦਾ ਕੰਪੇਅਰ ਕਰਦੇ ਹਾਂ ਦੂਸਰੀ ਕੰਟਰੀਜ਼ ਨਾਲ ਆਪਣੇ ਆਪ ਨੂੰ ਤੁਲਨਾ ਕਰੀਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਉਹ ਇਸ ਮਾਮਲੇ 'ਚ ਬਹੁਤ ਅੱਗੇ ਨੇ ਉਹ ਸਾਡੇ ਤੋਂ ਸਿਰਫ ਇੱਕ ਪੁਆਇੰਟ ਤੋਂ ਅੱਗੇ ਸਾਡੇ ਬੱਚੇ ਮਿਹਨਤੀ ਨੇ ਸਭ ਕੁਛ ਨੇ ਲੇਕਿਨ ਜਦੋਂ ਪ੍ਰੈਕਟੀਕਲ ਸ਼ਿਕਸ਼ਾ ਦੀ ਗੱਲ ਆਉਂਦੀ ਹੈ ਉਦੋਂ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਰਨਾ ਹੈ ਔਨਲਾਈਨ ਹੁਣ ਡਿਜੀਟਲ ਸਭ ਕੁਛ ਹੋ ਗਿਆ ਹੈ ਲੇਕਿਨ ਹਜੇ ਵੀ ਟਾਈਮ ਲੱਗੇਗਾ ਸਿਰਫ਼ ਡਿਜੀਟਲ ਹੋਣਾ ਹੀ ਜ਼ਰੂਰੀ ਨਹੀਂ ਹੈ ਉਸ ਚੀਜ਼ ਦਾ ਮੇਰੇ ਹਿਸਾਬ ਨਾਲ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਜਿੱਦਾਂ ਕੰਪਿਊਟਰਸ 'ਚ ਜੇ ਇੱਕ ਬੱਚੇ ਦਾ ਜਿਸ ਚੀਜ਼ 'ਚ ਪਹਿਲੇ ਤੁਹਾਨੂੰ ਇਹ ਪੁੱਛਣਾ ਚਾਹੀਦਾ ਕਿ ਉਹਦੀ ਰੁਚੀ ਕੀ ਹੈ ਫਿਰ ਉਸ ਨੂੰ ਸਿਰਫ਼ ਉਸੇ ਦੇ ਰਿਲੇਟਿਡ ਪੜ੍ਹਾਉਣਾ ਚਾਹੀਦਾ ਜਿੱਦਾਂ ਕਿ ਬਾਹਰ ਦੇ ਦੇਸ਼ਾਂ 'ਚ ਹੁੰਦਾ ਹੈ ਉਹਨਾਂ ਨੂੰ ਬਿਨਾਂ ਮਤਲਬ ਦੀ ਐਜੂਕੇਸ਼ਨ ਸਿੱਖਿਆ ਨਹੀਂ ਦਿੱਤੀ ਜਾਂਦੀ